ਮੈਂ ਕਿਸਾਨ ਹਾਂ ਅਸੀਂ ਖੇਤੀ ਕਰਦੇ ਹਾਂ ਕਿਉਂਕਿ ਸਾਨੂੰ ਖੇਤੀ ਕਰਨਾ ਸਾਡੇ ਅਸੀਂ ਸ਼ੁਰੂ ਤੋਂ ਹੀ ਖੇਤੀ ਕਰਦੇ ਆ ਰਹੇ ਹਾਂ ਅਤੇ ਜੋ ਕਿ ਸਾਡੀਆਂ ਫਸਲਾਂ ਹੈ ਉਹਨਾਂ ਦਾ ਸਾਨੂੰ ਆੜ੍ਹਤੀਏ ਅਤੇ ਸਰਕਾਰਾਂ ਮੁੱਲ ਪੂਰਾ ਨਹੀਂ ਦਿੰਦੀਆਂ ਕਿਉਂਕਿ ਆੜ੍ਹਤੀਏ ਨੂੰ ਤਾਂ ਇਹ ਹੁੰਦਾ ਹੈ ਕਿ ਅਸੀਂ ਉਹਨਾਂ ਤੋਂ ਵਿਆਜ ਤੋਂ ਪੈਸਾ ਲੈਂਦੇ ਹਾਂ ਅਤੇ ਅਸੀਂ ਹੋਰ ਕਿਤੇ ਅਸੀਂ ਆਪਣੀ ਫਸਲ ਨੂੰ ਵੇਚ ਨਹੀਂ ਸਕਦੇ ਸਾਨੂੰ ਇਸ ਲਈ ਆੜ੍ਹਤੀਏ ਦੇ ਫਸਲ ਵੇਚਣੀ ਪੈਂਦੀ ਹੈ ਕਿਉਂਕਿ ਸਾਨੂੰ ਅਸੀਂ ਇਹਨਾਂ ਤੋਂ ਪੈਸਾ ਵਸੂਲਿਆ ਹੁੰਦਾ ਲਿਆ ਹੁੰਦਾ ਹੈ ਅਤੇ ਆੜ੍ਹਤੀਏ ਜੋ ਸਾਡੇ ਤੋਂ ਸਸਤੇ ਭਾਅ ਸਾਡੀਆਂ ਫਸਲਾਂ ਜੋ ਵਸੂਲ ਕਰ ਲੈਂਦੇ ਹਨ ਅਤੇ ਸਾਨੂੰ ਪੂਰਾ ਮੁੱਲ ਨਹੀਂ ਦਿੰਦੇ ਇਸ ਲਈ ਜੋ ਅਸੀਂ ਕਿਸਾਨ ਹਾਂ ਅਤੇ ਸਾਡੇ ਨੂੰ ਜ਼ਿਆਦਾਤਰ ਵਿਆਜ ਪੈ ਜਾਂਦਾ ਹੈ ਜੋ ਕਿ ਸਾਡੀਆਂ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲਦਾ ਹੈਗਾ ਅਤੇ ਫਿਰ ਅੱਕਿਆ ਹੋਇਆ ਕਿਸਾਨ ਖੁਦਕੁਸ਼ੀਆਂ ਕਰਦਾ ਹੈ ਕਿਉਂਕਿ ਪ੍ਰੋਪਰ ਸਾਨੂੰ ਫਸਲਾਂ ਦਾ ਮੁੱਲ ਨਹੀਂ ਮਿਲਦਾ ਕਈ ਵਾਰੀ ਕੁਦਰਤ ਵੱਲੋਂ ਜਾਂ ਪ੍ਰਮਾਤਮਾ ਵੱਲੋਂ ਇਹੋ ਜਿਹਾ ਕਹਿਰ ਆਉਂਦਾ ਹੈ ਮੀਂਹ ਕਰਕੇ ਜਾਂ ਬਾਰਿਸ਼ ਕਰਕੇ ਕਿ ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ ਇਸ ਕਰਕੇ ਕਿਸਾਨ ਹੈ ਜੋ ਉਹਨਾਂ ਨੂੰ ਸਿਰਫ ਆੜ੍ਹਤੀਏ 'ਤੇ ਅਤੇ ਸਰਕਾਰਾਂ 'ਤੇ ਉਮੀਦ ਹੁੰਦੀ ਹੈ ਕਿ ਸਾਨੂੰ ਚੰਗਾ ਮੁੱਲ ਮਿਲ ਜਾਵੇ ਅਤੇ ਚੰਗੇ ਭਾਅ ਸਾਡੀਆਂ ਫਸਲਾਂ ਲੱਗ ਜਾਣ ਪਰ ਜੋ ਕਿਸ ਸਰਕਾਰਾਂ ਅਤੇ ਆੜ੍ਹਤੀਏ ਹਨ ਉਹ ਸਾਡੀਆਂ ਫਸਲਾਂ ਦਾ ਪੂਰਾ ਮੁੱਲ ਨਹੀਂ ਦਿੰਦੇ ਅਤੇ ਇਸ ਕਰਕੇ ਕਿਸਾਨ ਅੱਕਿਆ ਹੋਇਆ ਖੁਦਕੁਸ਼ੀ ਕਰ ਲੈਂਦਾ ਹੈ ਧੰਨਵਾਦ ਜੀ